ਸਭ ਤੋਂ ਪਹਿਲਾਂ ਤਾਂ ਮੈਂ ਜੇ ਆਪਣੀ ਜਿਹੜੀ ਗਲਤ ਆਕਾਰ ਦੀ ਜਿਹੜੀ ਹੈਗੀ ਹੈ ਜੀਨਸ ਵਗੈਰਾ ਮੈਂ ਓਡਰ ਕਰ ਦਿੱਤੀਆਂ ਹੈਗੀਆਂ ਹੈ ਤਾਂ ਉਹਦੇ ਵਾਸਤੇ ਮੈਂ ਜਿਹੜੇ ਉੱਥੇ ਦੇ ਜਿਹੜਾ ਜਿੱਦਾਂ ਕੋਈ ਪ੍ਰੋਪਰ ਜਿਹੜੀ ਸਾਈਟ ਹੈਗੀ ਹੈ ਜਾਂ ਜਿੱਦਾਂ ਕੋਈ ਵੀ ਹੈਗਾ ਜਿਹੜਾ ਐਪ ਵਗੈਰਾ ਹੈਗਾ ਹੈ ਤਾਂ ਉਹਦੇ ਮੈਂ ਹੈਗਾ ਕਸਟਮਰ ਕੇਅਰ ਨੂੰ ਪਹਿਲਾਂ ਕੌਲ ਕਰੂੰਗਾ ਅਤੇ ਉਨ੍ਹਾਂ ਤੋਂ ਪੁੱਛੂੰਗਾ ਬਈ ਭਾਈ ਮੈਂ ਕਿਸ ਹਿਸਾਬ ਨਾਲ ਜਾਂ ਕਿਹੜੇ ਤਰੀਕੇ ਨਾਲ ਬਈ ਜਿਹੜਾ ਹੈਗਾ ਹੈ ਮੈਂ ਇਹਦਾ ਜਿਹੜਾ ਓਡਰ ਵਗੈਰਾ ਹੈਗਾ ਆਪਣੀ ਜੀਨਸ ਵਗੈਰਾ ਦਾ ਇਹਨੂੰ ਮੈਂ ਉਹ ਕੈਂਸਲ ਕਰ ਸਕਦਾ ਹੈਗਾ ਹੈ ਜਿਹਦੇ ਨਾਲ਼ ਨਾ ਬਈ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਹੋਵੇ ਅਤੇ ਨਾ ਹੀ ਕੋਈ ਮੈਨੂੰ ਪਰੇਸ਼ਾਨੀ ਹੋਵੇ ਤਾਂ ਜੋ ਬਾਅਦ 'ਚੋਂ ਮੈਂ ਵਾਪਸ ਫੇਰ ਵੀ ਕਰਨਾ ਪੈਣਾ ਹੈ ਅਤੇ ਉਹਨਾਂ ਦਾ ਵੀ ਟਾਈਮ ਬਚੇ ਅਤੇ ਮੇਰੇ ਕੋਲ ਵੀ ਜਿਹੜਾ ਹੈਗਾ ਪਾਰਸਲ ਪੂਰੇ ਟੈਮ ਨਾਲ ਪੁੱਜ ਸਕੇ ਤਾਂ ਇਸ ਤਰ੍ਹਾਂ ਮੈਂ ਉਹ ਤੋਂ ਬਾਅਦ ਕੌਲ ਕਰੂੰਗਾ ਅਤੇ ਉਹ ਤੋਂ ਬਾਅਦ ਜਿੱਦਾਂ ਹੁਣ ਮੇਰਾ ਹੈਗੀ ਜਿਹੜਾ ਮੇਰਾ ਮੈਂ ਜੀਨਸ ਵਗੈਰਾ ਹੈਗੀ ਹੈ ਮੈਂ ਥਰਟੀ ਸਿਕਸ ਲੱਕ ਆਉਂਦਾ ਹੈਗਾ ਹੈ ਲੱਕ ਮੇਰਾ ਥਰਟੀ ਸਿਕਸ ਹੈਗਾ ਹੈ ਤਾਂ ਉਹਦੇ ਹਿਸਾਬ ਨਾਲ ਮੈਂ ਜਿਹੜੀ ਨਾ ਮੈਂ ਚੌਂਤੀ ਵਗੈਰਾ ਓਡਰ ਕਰ ਲਈ ਸੀਗੀ ਤਾਂ ਉਹਦੇ ਹਿਸਾਬ ਨਾਲ ਮੈਂ ਹੈਗਾ ਹੈ ਉਹਨੂੰ ਚੇਂਜ ਕਰਕੇ ਮੈਂ ਆਪਣੀ ਜੀਨਸ ਵਗੈਰਾ ਦਾ ਜਿਹੜਾ ਲੱਕ ਵਗੈਰਾ ਜਾਂ ਕੁਛ ਵੀ ਲੈਂਥ ਵਗੈਰਾ ਹੈਗੀ ਹੈ ਉਹ ਸਾਰਾ ਕੁਛ ਚੇਂਜ ਕਰਨ ਵਾਸਤੇ ਮੈਂ ਪ੍ਰੋਸੀਜਰ ਫੋਲੋ ਕਰੂੰਗਾ ਜਿੱਦਾਂ ਵੀ ਮੈਨੂੰ ਕਸਟਮਰ ਕੇਅਰ ਵਗੈਰਾ ਕਹੂੰਗੇ